ਅਜੋਕੇ ਸਮੇਂ ਵਿੱਚ ਤਣਾਅ ਭਰੇ ਸਥਿਤੀ ਵਿੱਚ ਕਿਤਾਬਾਂ ਫਿਲਮਾਂ ਅਤੇ ਟੀਵੀ ਸ਼ੋਅ ਜਾਂ ਸੰਗੀਤ ਤੁਹਾਡੇ ਦਿਮਾਗ ਨੂੰ ਸਥਿਰ ਰੱਖਦਾ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਕੰਮ ਕਾਜ ਦੇ ਪ੍ਰੈਸ਼ਰ ਅਤੇ ਰੋਜ਼ਾਨਾ ਦੀ ਦੌੜ ਭੱਜ ਆਦਿ ਦੀ ਜ਼ਿੰਦਗੀ ਵਿੱਚ ਇਹ ਨਾਲ ਨਾਲ ਹੋਰ ਕ ਐਕਟੀਵਿਟੀਆਂ ਹੋਣੀਆਂ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹਨ ਮੈਨੂੰ ਲਾਫਟਰ ਸ਼ੋਅ ਬਹੁਤ ਪਸੰਦ ਹੈ ਕਿਉਂਕਿ ਇਹ ਤਨਾਅ ਨੂੰ ਘੱਟ ਕਰਦਾ ਹੈ ਇਸ ਵਿੱਚ ਵੱਖ ਵੱਖ ਕਲਾਕਾਰਾਂ ਵੱਲੋਂ ਸਕਿੱਟਾਂ ਆਦਿ ਰਾਹੀਂ ਆਪਣੀ ਕਲਾ ਦਾ ਉਹ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਹੱਸਣ ਖੇਡਣ ਮਨ ਕਾ ਚਾਉ ਇਸ ਲਈ ਮੈਨੂੰ ਇਹ ਸ਼ੋਅ ਬਹੁਤ ਵਧੀਆ ਲੱਗਦਾ ਹੈ ਇਹ ਸਾਰੇ ਦਿਨ ਦੀ ਥਕਾਨ ਨੂੰ ਦੂਰ ਕਰਦਾ ਹੈ ਕਿਉਂਕਿ ਹੱਸਣ ਨਾਲ ਇੱਕ ਐਨਰਜੀ ਦਾ ਲੈਵਲ ਸਰੀਰ ਵਿੱਚ ਵੱਧਦਾ ਹੈ ਕਿਉਂਕਿ ਕਿਉਂਕ ਮੌਜੂਦਾ ਸਮੇਂ ਵਿੱਚ ਖਬਰਾਂ ਆਦਿ ਦੇਖਣ ਨਾਲ ਇੱਕ ਦਿਮਾਗ ਵਿੱਚ ਨਕਾਰਾਤਮਕ ਸੋਚ ਪੈਦਾ ਹੁੰਦੀ ਹੈ ਇਸ ਲਈ ਮੈਨੂੰ ਇਹ ਲਾਫਟਰ ਸ਼ੋਅ ਬਹੁਤ ਵਧੀਆ ਲੱਗਦਾ ਹੈ ਇਹ ਇਸ ਤੋਂ ਇਲਾਵਾ ਇਹ ਜਿੱਦਾਂ ਹਫਤੇ ਦੇ ਅਖੀਰਲੇ ਦਿਨਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਪ੍ਰਸਾਰਿਤ ਹੁੰਦਾ ਏ ਇਸਦਾ ਸਮਾਂ ਇੱਕ ਘੰਟਾ ਹੈ ਅਤੇ ਮੈਂ ਪੂਰੇ ਹਫਤੇ ਦੀ ਅਤੇ ਆਪਣੀ ਥਕਾਨ ਮਿਟਾ ਲੈਂਦਾ ਹਾਂ ਇਸ ਤੋਂ ਇਲਾਵਾ ਕਦੇ ਕਦੇ ਮੈਂ ਇਹ ਸ਼ੋਅ ਨੂੰ ਯੂਟਿਊਬ ਰਾਹੀਂ ਇਹਨੂੰ ਦੇਖ ਲੈਂਦਾ ਹਾਂ ਜਦੋਂ ਕਈ ਵਾਰ ਇਹ ਸ਼ੋਅ ਮੇਰੇ ਦੁਆਰਾ ਮਿਸ ਕਰ ਲਿਆ ਜਾਂਦਾ ਹੈ ਇਸ ਇਹ ਸ਼ੋਅ ਮੈਨੂੰ ਬਹੁਤ ਪਸੰਦ ਹੈ